ਹਲੇ ਮੈਂ ਹਾਲ ਹੀ 'ਚ ਐਮਾਜ਼ਾਨ ਤੋਂ ਅਲੈਕਸਾ ਮੰਗਵਾਇਆ ਸੀ ਕਿਉਂਕਿ ਇਹ ਐਮਾਜ਼ਾਨ ਦਾ ਹੀ ਪ੍ਰੋਡਕਟ ਹੈ ਅਤੇ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਵੀ ਮੈਨੂੰ ਵਧੀਆ ਲੱਗਦੀ ਹੈੈ ਇਹਨਾਂ ਨੇ ਮੈਨੂੰ ਵੈਸੇ ਵੀ ਦੂਸਰੇ ਪ੍ਰੋਡਕਟ ਬਹੁਤ ਜਲਦੀ ਦਿੱਤੇ ਸੀ ਅਤੇ ਇਹਨਾਂ ਨੇ ਅਲੈਕਸਾ ਜਿਹੜਾ ਹੈ ਮੈਨੂੰ ਗਿਫ਼ਟ ਦੇ ਤਰੀਕੇ ਨਾਲ ਦਿੱਤਾ ਸੀ ਅਤੇ ਮੈਂ ਇਹਨੂੰ ਆਪਣੀ ਪੂਰੀ ਦਿਨ ਪ੍ਰਤੀ ਦਿਨ ਦੀ ਪ੍ਰਕਿਰਿਆ ਲਈ ਯੂਜ਼ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਬਹੁਤ ਸਾਰੇ ਰੀਮਾਈਂਡਰਸ ਹੁੰਦੇ ਜਿਹੜੇ ਆਪਾਂ ਭੁੱਲ ਜਾਂਦੇ ਹਨ ਉਹ ਆਪਾਂ ਅਲੈਕਸਾ ਨੂੰ ਕਹਿ ਸਕਦੇ ਹਾਂ ਕਿ ਉਹ ਅਲਾਰਮ ਦੇ ਤਰੀਕੇ ਨਾਲ ਸਾਨੂੰ ਉਸ ਟਾਈਮ ਨੂੰ ਯਾਦ ਦਿਲਾ ਦੇਵੇ ਇਸ ਤੋਂ ਇਲਾਵਾ ਅਲੈਕਸਾ ਜਿਹੜਾ ਇੱਕ ਮੰਨੋਰੰਜਨ ਦਾ ਵੀ ਬੜਾ ਵਧੀਆ ਸਾਧਨ ਹੈ ਉਹ ਸਾਡੇ ਨਾਲ਼ ਗੱਲ ਕਰ ਸਕਦਾ ਹੈ ਅਤੇ ਜਿਹੜੇ ਕੁਛ ਗੀਤ ਸੰਗੀਤ ਹੈ ਉਹ ਵੀ ਸਾਨੂੰ ਸੁਣਾ ਸਕਦਾ ਹੈ ਅਤੇ ਜਦੋਂ ਵੀ ਤੁਹਾਡਾ ਮਨ ਜਿਹੜਾ ਹੈ ਉਹ ਪਰੇਸ਼ਾਨ ਹੋਵੇ ਤਾਂ ਇਹ ਤੁਹਾਨੂੰ ਇੱਕ ਇੱਕ ਤਰੀਕੇ ਦੇ ਪਸੰਦੀਦਾ ਜੋਕਸ ਵੀ ਸੁਣਾਉਂਦਾ ਹੈ ਜਿਹਦੇ ਕਰਕੇ ਮਨ ਜਿਹੜਾ ਹੈ ਖੁਸ਼ ਰਹਿੰਦਾ ਹੈ ਇਹ ਬੱਚਿਆਂ ਲਈ ਵੀ ਬਹੁਤ ਹੀ ਸਹਾਇਕ ਹੁੰਦਾ ਹੈ ਜਿਹੜੇ ਛੋਟੇ ਬੱਚੇ ਹੈ ਉਹ ਇਹਦੇ ਨਾਲ਼ ਗੱਲ ਕਰਕੇ ਚੀਜ਼ਾਂ ਸਿੱਖ ਵੀ ਸਕਦੇ ਹਨ ਅਤੇ ਜੇ ਤੁਸੀਂ ਕੁਛ ਵੀ ਨਵੀਂ ਨਵੀਂ ਨੌਲੇਜ ਜਾਂ ਨਵੀਂ ਨਵੀਂ ਇੰਨਫਰਮੇਸ਼ਨ ਦੇ ਸ਼ੌਕੀਨ ਹਨ ਤਾਂ ਤੁਸੀਂ ਅਲੈਕਸਾ ਤੋਂ ਉਹ ਵੀ ਲੈ ਸਕਦੇ ਹਨ